ਮੂਰਤੀਆਂ ਵਿਚ ਅਸੀਂ ਗੈਰਵਰਤੀ ਸਮੱਗਰੀ ਸ਼ਾਮਿਲ ਕਰਦੇ ਹਨ ਜਿਵੇਂ ਕਿ ਮੂਰਤੀ ਮਿੱਟੀ ਦੇ ਵਿੱਚ ਮਿੱਟੀ ਦੀਆਂ ਮੂਰਤੀਆਂ ਦੇ ਰੰਗ ਰੋਗਨ ਕਰਦੇ ਹਾਂ ਮੋਤੀ ਵਗੈਰਾ ਲਗਾ ਦਿੰਦੇ ਹਾਂ ਜਿਵੇਂ ਕਿ ਉਹਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਸੋਹਣੇ ਥੇ ਬਣਾਉਣ ਵਾਸਤੇ ਮੁਰਤੀਆਂ ਦੇ ਉੱਪਰ ਰੰਗ ਰੋਗਨ ਅਤੇ ਮੋਤੀ ਵਗੈਰਾ ਤੇਲ ਵਗੈਰਾ ਜਿਸ ਤਰ੍ਹਾਂ ਇਸ ਤਰ੍ਹਾਂ ਲਗਾ ਕੇ ਬਹੁਤ ਵਧੀਆ ਮੂਰਤੀਆਂ ਬਣਾਉਂਦੇ ਹੈ ਬਣਾਈ ਜਾਂਦੀ ਹਨ